ਅੱਜ ਕੱਲ੍ਹ ਸੂਟਾਂ ਦੇ ਰੰਗ ਬਲੈਕ ਪਿੰਕ ਵਾਈਟ ਗਰੀਨ ਹਰਾ ਅਤੇ ਡਿਜਾਇਨਰ ਫੈਸ਼ਨ ਵਿੱਚ ਮੈਨੂੰ ਪੰਜਾਬੀ ਸੂਟ ਸ਼ਰਾਰਾ

ਸ਼ਰਾਰਾ ਪਲਾਜੋ ਨੈਰੋ ਪੈ ਸਲਵਾਰ ਕੁੜਤੀ ਬਹੁਤ ਅੱਜ ਦੇ ਟਰੈਂਡ ਦਾ ਰਿਵਾਜ ਬਹੁਤ ਹੈ